ਮੈਨੂੰ ਸ਼ੁਰੂ ਤੋਂ ਹੀ ਗਾਉਣ ਦਾ ਬਹੁਤ ਜ਼ਿਆਦਾ ਸ਼ੌਂਕ ਰਿਹਾ ਹੈ ਔਰ ਮੈਂ ਕਾਫੀ ਪੰਜਾਬ ਦੇ ਨਾਮਵਾਰ ਸਿੰਗਰਾਂ ਦੇ ਨਾਲ ਪਿੱਛੇ ਕੋਰਸ ਵੀ ਬੋਲਿਆ ਹੈ ਜਿਵੇਂ ਕਿ ਦੁਰਗਾ ਰੰਗੀਲਾ ਮਾਸਟਰ ਸਲੀਮ ਇਹਨਾਂ ਦੇ ਪਿੱਛੇ ਕੋਰਸ ਬੋਲਿਆ ਮੈਂ ਸੋਚਦਾ ਹਾਂ ਵੀ ਜਿਵੇਂ ਇਹ ਬੜੀਆਂ ਬੜੀਆਂ ਸਟੇਜਾਂ 'ਤੇ ਗਾਉਂਦੇ ਆ ਇਹਨਾਂ ਦਾ ਜ਼ਿੰ ਦੁਨੀਆ ਦੇ ਵਿੱਚ ਨਾਮ ਹੈ ਮੇਰਾ ਵੀ ਇੱਦਾਂ ਨਾਮ ਹੋਵੇ ਮੈਂ ਜ਼ਿੰਦਗੀ 'ਚ ਗਾਇਕੀ ਦੇ ਉੱਚੇ ਮੁਕਾਮ ਤੱਕ ਪਹੁੰਚਣਾ ਚਾਹੁੰਦਾਂ ਜਿਵੇਂ ਮਿਊਜ਼ੀਕ ਦੇ ਮਿਊਜ਼ੀਕ ਇੰਡਸਟਰੀ ਦੇ ਬਹੁਤ ਹੀ ਨਾਮਵਰ ਮਿਊਜ਼ੀਕ ਡਾਇਰੈਕਟਰ ਜਨਾਬ ਚਰਨਜੀਤ ਅਹੁਜਾ ਸਾਹਿਬ ਹਨ ਉਹਨਾਂ ਦੀ ਮਿਊਜ਼ੀਕ ਦੇ ਵਿੱਚ ਇੱਕ ਪੂਰੀ ਐਲਬਮ ਕਰਨੀ ਚਾਹੁੰਦਾਂ ਔਰ ਬੜੀਆਂ ਬੜੀਆਂ ਸਟੇਜਾਂ 'ਤੇ ਸ਼ੋਅ ਕਰਨੇ ਚਾਹੁੰਦਾਂ ਜਿਵੇਂ ਬੜੇ ਬੜੇ ਸਿੰਗਰਾਂ ਨੇ ਅਰੀਜੀਤ ਸਿੰਘ ਹੋ ਗਿਆ ਸੁਖਵਿੰਦਰ ਸਿੰਘ ਹੋ ਗਿਆ ਦਿਲਜੀਤ ਹੋ ਗਿਆ ਇੰਦਰਜੀਤ ਨਿੱਕੂ ਹੋ ਗਿਆ ਜਿਵੇਂ ਇਹਨਾਂ ਨੇ ਆਪਣੀ ਜ਼ਿੰਦਗੀ 'ਚ ਆਪਣਾ ਨਾਮ ਪੂਰੀ ਦੁਨੀਆਂ ਦੇ ਵਿੱਚ ਕਮਾਇਆ ਹੈ ਇਸ ਤਰ੍ਹਾਂ ਮੈਂ ਆਪਣਾ ਨਾਮ ਬਣਾਉਣਾ ਚਾਹੁੰਦਾ ਹਾਂ ਔਰ ਪੰਜਾਬੀ ਭਾਸ਼ਾ ਨੂੰ ਜੋ ਉਹਦਾ ਬਣਦਾ ਮੁਕਾਮ ਹੈ ਦੁਆਣਾ ਚਾਹੁੰਦਾ ਹਾਂ